ਹਾਲ ਹੀ ਦੇ ਸਾਲਾਂ ਵਿੱਚ ਭਾਰਤ ਸਰਕਾਰ ਵੱਲੋਂ ਬਹੁਤ ਵੱਡਾ ਬਦਲਾਵ ਲਿਆਉਂਦਾ ਗਿਆ ਹੈ ਉੱਨੀ ਸੌ ਇਕਾਨਵੇਂ ਵਿੱਚ ਐੱਲ ਪੀ ਜੀ ਪੋਲਿਸੀ ਲਿਬਰਲਾਈਜੇਸ਼ਨ ਐਂਡ ਪ੍ਰਾਈਵਟਾਈਜੇਸ਼ਨ ਇਹਨਾਂ ਨੇ ਚਲਾਈ ਸੀ ਅਤੇ ਉਹਦੇ ਕਰਕੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਤਰੱਕੀ ਦਾ ਕਾਰਨ ਵਿੱਚ ਮੁੱਖ ਯੋਗਦਾਨ ਪਾਇਆ ਹੈ ਆਈ ਟੀ ਸੈਕਟਰ ਅਤੇ ਖੇਤੀਬਾੜੀ ਅਤੇ ਆਪਣਾ ਇੰਨਫਰਾਸਟ੍ਰਕਚਰ ਕੰਪਨੀਸ ਨੇ ਜੋ ਕਿ ਦੇਸ਼ ਨੂੰ ਤਰੱਕੀ ਦੇ ਦੌਰ ਵੱਲ ਲੈ ਗਿਆ ਹੈ ਅਤੇ ਅੱਜ ਭਾਰਤ ਦੇਸ਼ ਪੰਜਵੇਂ ਨੰਬਰ ਦਾ ਵਿਸ਼ਵ ਦੇ ਪੰਜਵੇਂ ਨੰਬਰ ਦਾ ਅਰਥਚਾਰਾ ਬਣ ਚੁੱਕਿਆ ਹੈ ਜਿਹਦਾ ਦੇਸ਼ ਵਿਦੇਸ਼ ਵਿੱਚ ਨਾਂ ਵੱਜਦਾ ਹੈ ਅਤੇ ਅੱਜ ਕੱਲ੍ਹ ਲੋਕ ਡਿਜੀਟਲ ਐਂਡ ਡਿਜੀਟਲ ਔਨਲਾਈਨ ਬੈਂਕਿੰਗ ਕਰਦੇ ਹਨ ਇਸ ਦੇ ਰਾਹੀਂ ਲੋਕਾਂ ਦਾ ਟਾਈਮ ਵੀ ਸੇਵ ਹੁੰਦਾ ਹੈ ਅਤੇ ਲੋਕ ਹਾਂ ਸੇਫਲੀ ਆਪਣੇ ਪੈਸੇ ਇੱਧਰ ਉੱਧਰ ਟ੍ਰਾਂਸਫਰ ਕਰਦੇ ਰਹਿੰਦੇ ਹਨ ਸੋ ਇਸ ਨੇ ਬਹੁਤ ਇਨ ਇਹ ਤਰੱਕੀ ਦੀਆਂ ਨਿਸ਼ਾਨੀਆਂ ਨੇ ਅਤੇ ਹੋਰ ਵੀ ਅੱਗੇ ਤ ਭਾਰਤ ਦੇਸ਼ ਤਰੱਕੀ ਕਰ ਰਿਹਾ ਹੈ ਟੈਕਨੋਲੌਜੀ ਵਿੱਚ ਵਾਧਾ ਕਰ ਰਿਹਾ ਹੈ